ਹਾਂਜੀ ਮੈਂ ਪੇਂਟਿੰਗ ਦੇ ਸੂਟ ਪੇਂਟਾਂ ਦੇ ਨਾਲ ਨਾਲ ਮੈਂ ਪੈਨਸਿਲ ਸਕੈਚਿੰਗ ਵੀ ਕਰ ਲੈਂਦੀ ਹਾਂ ਜਿਸ ਤਰ੍ਹਾਂ ਕੋਈ ਸਕੈੱਚ ਆ ਜਾਂਦਾ ਹੈ ਕੋਈ ਪੇਂਟ ਪੇਂਟਿੰਗ ਬਣਾਉਣੀ ਹੁੰਦੀ ਆ ਪਹਿਲਾਂ ਅਸੀਂ ਕਾਗਜ਼ ਲੈਂਦੇ ਹਾਂ ਉਹਦੇ ਉੱਤੇ ਰਫ ਡਰਾਇੰਗ ਕਰਦੇ ਹਾਂ ਚਿੱਤਰ ਬਣਾਉਂਦੇ ਹਾਂ ਜਾਂ ਕੋਈ ਪੰਛੀ ਹੋ ਗਏ ਫ ਫੁੱਲ ਹੋ ਗਏ ਕੋਈ ਬਿਲਡਿੰਗ ਹੋ ਗਈ ਉਹਨਾਂ ਦੀ ਸਕੈਚਿੰਗ ਵੀ ਕਰ ਲੈਂਦੇ ਹਾਂ ਕਿਸੇ ਬੰਦੇ ਦੀ ਸ਼ਕਲ ਬਣਾਉਣੀ ਹੋਵੇ ਜਾਂ ਕੱਪੜਿਆਂ ਦੀ ਡਰੈਸਾਂ ਬਣਾਉਣੀਆਂ ਹੋਣ ਇਹ ਅਸੀਂ ਪੈਨਸਿਲ ਦੇ ਨਾਲ ਸਕੈਚਿੰਗ ਕਰ ਲੈਂਦੇ ਹਾਂ ਅਤੇ ਸੌਖਾ ਜ਼ਿਆਦਾ ਤਾਂ ਸੌਖਾ ਹੈਗੀ ਡਰਾਇੰਗ ਆ ਕਾਪੀ ਉੱਤੇ ਕੰਮ ਕਰਨਾ ਕਿਉਂਕਿ ਕੰਮ ਕਰਨ ਵਾਸਤੇ ਸਾਨੂੰ ਪੈਨਸਿਲ ਸਕੈੱਚ ਅਤੇ ਨਾਲ ਹੀ ਸਾਨੂੰ ਇਹ ਕਾਗਜ਼ ਦੀ ਲੋੜ ਹੁੰਦੀ ਹੈ ਜੋ ਕਿ ਸਾਨੂੰ ਸਸਤਾ ਅਤੇ ਸੌਖਾ ਆਸਾਨੀ ਨਾਲ ਮਿਲ ਜਾਂਦਾ ਹੈ ਅਤੇ ਇਹਦੇ ਉੱਤੇ ਅਸੀਂ ਜਿਸ ਤਰੀਕੇ ਨਾਲ ਮਰਜ਼ੀ ਕਰ ਸਕਦੇ ਹਾਂ ਫਿਰ ਇਹਨੂੰ ਜੇ ਗਲਤੀ ਹੋ ਵੀ ਜਾਵੇ ਤਾਂ ਇਸ ਨੂੰ ਅਸੀਂ ਸਾਫ ਕਰਕੇ ਦੁਬਾਰਾ ਵੀ ਕਰ ਸਕਦੇ ਹਾਂ